ਸਤਿ ਸ਼੍ਰੀ ਅਕਾਲ ਜੀ ਸਰ ਮੈਂ ਤੁਹਾਡੀ ਕੰਪਨੀ ਤੋਂ ਇੱਕ ਫ਼ੋਨ ਔਡਰ ਕੀਤਾ ਸੀ ਵੀਹ ਜੂਨ ਨੂੰ ਅਤੇ ਉਹ ਮੇਰੇ ਕੋਲ ਪਹਿਲਾਂ ਤਾਂ ਸਹੀ ਟਾਇਮ 'ਤੇ ਨਹੀਂ ਪਹੁੰਚਿਆ ਬਹੁਤ ਲੇਟ ਪਹੁੰਚਿਆ ਮੇਰੇ ਕੋਲ ਅਤੇ ਜਦੋਂ ਮੈਂ ਉਸਦੀ ਪੈਕਿੰਗ ਖੋਲ੍ਹ ਕੇ ਦੇਖੀ ਤਾਂ ਉਸਦੀ ਹਾਲਤ ਵਿੱਚੋਂ ਠੀਕ ਨਹੀਂ ਸੀ ਨਿਕਲੀ ਅਤੇ ਉਸਦੀ ਟੱਚ 'ਤੇ ਵੀ ਝਰੀਟਾਂ ਵੱਜੀਆਂ ਹੋਈਆ ਸਨ ਜਦੋਂ ਮੈਂ ਉਸਨੂੰ ਔਨ ਕਰਕੇ ਦੇਖਿਆ ਚਲਾ ਕੇ ਦੇਖਿਆ ਤਾਂ ਉਸਦਾ ਕੈਮਰਾ ਵੀ ਨਹੀਂ ਸਹੀ ਚੱਲਦਾ ਸੀਗਾ ਕੌਲਿੰਗ ਵੀ ਸਹੀ ਨਹੀਂ ਹੁੰਦੀ ਸੀਗੀ ਅਤੇ ਉਸਦੀ ਅਵਾਜ਼ ਵੀ ਨਹੀਂ ਸਹੀ ਆ ਰਹੀ ਸੀਗੀ ਬਟਨ ਵਗੈਰਾ ਵੀ ਟੁੱਟੇ ਹੋਏ ਸੀਗੇ ਸਾਈਡ ਤੋਂ ਅਤੇ ਪੈਕਿੰਗ ਦੇ ਵਿੱਚ ਹੀ ਪ੍ਰੋਬਲਮ ਸੀਗੀ ਅਤੇ ਮੇਰੇ ਤਾਂ ਜੀ ਪੈਸੇ ਵੀ ਖਰਾਬ ਹੋ ਗਏ ਇਸ ਕਰਕੇ ਮੈਂ ਤੁਹਾਨੂੰ ਰੀਫੰਡ ਕਰਨ ਲਈ ਕਹਿ ਰਿਹਾ ਹੈ ਤਾਂ ਕਿ ਮੈਂ ਕੋਈ ਹੋਰ ਫ਼ੋਨ ਲੈ ਸਕਾਂ